ਹੈਲੋ ਮੈਂ ਹਜੇ ਤਲਵੰਡੀ ਆ ਮੇਰੇ ਤੋਂ ਮੇਰੀ ਇੱਥੋਂ ਬੱਸ ਮੈਨੂੰ ਮਿਲੀ ਨਹੀਂ ਬਸ ਅ ਇੱਥੋਂ ਨਿਕਲ ਗਈ ਸੀਗੇ ਮੈਂ ਥੋੜ੍ਹਾ ਲੇਟ ਹੋ ਗਿਆ ਸੀ ਉਦੋਂ ਬਾਅਦ ਦੀ ਬੱਸ ਦਾ ਲਗਭਗ ਅ ਵੀਹ ਬਾਈ ਮਿੰਟਾਂ ਦਾ ਗੈਪ ਆ ਵੇਖੋ ਮੇਰੇ ਹਿਸਾਬ ਨਾਲ ਥੋੜ੍ਹਾ ਬਹੁਤਾ ਲੇਟ ਹੋਊਗਾ ਬੱਸਾਂ ਨੇ ਬਹੁਤ ਖ਼ਰਾਬ ਕੀਤਾ ਹੋਇਆ ਹਾਂ ਤੁਸੀਂ ਕਿੱਥੇ ਪਹੁੰਚ ਗਏ ਅੱਛਾ ਮੈਂ ਤਾਂ ਫਿਰ ਤੁਹਾਡੇ ਤੋਂ ਵੀ ਪਿੱਛੇ ਹਾਂ ਇਹ ਸਟੂਡੈਂਟਸ ਦਾ ਕਰਨਾ ਚਾਹੀਦਾ ਇਹਨਾਂ ਨੂੰ ਕਾਰਡ ਪਿਆ ਵਗੈਰਾ ਹੋਣਾ ਚਾਹੀਦਾ ਪਾਸ ਵਗੈਰਾ ਬਣਿਆ ਹੋਣਾ ਬੱਸਾਂ ਵੀ ਹੋਰ ਲਾਉਣ ਬੱਸਾਂ ਵੀ ਹੋਰ ਲਾਉਣੀਆਂ ਚਾਹੀਦੀਆਂ ਹਾਂ ਜੋ ਟਾਈਮ ਸਿਰ ਪਹੁੰਚ ਜੇ ਮੈਂ ਤਾਂ ਫਿਰ ਤੁਹਾਡੇ ਤੋਂ ਵੀ ਪਿੱਛੇ ਮੇਰਾ ਤਾਂ ਫਿਰ ਔਖਾ ਹਾਂ ਆਹੀ ਤਾਂ ਗੱਲ ਆ ਦੇਖਦੇ ਹਾਂ ਕੀਦਾ ਕਿੰਨਾ ਕੁ ਟਾਈਮ ਲੱਗਦਾ ਹੋਰ ਤੁਹਾਨੂੰ ਹਾਂਜੀ ਪੜ੍ਹ ਕੇ ਆਏ ਹੋ ਹਾਂ ਇਹ ਤਾਂ ਹੈ ਮੇਰਾ ਹਿਸਾਬ ਬਸ 'ਚ ਬੈਠਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਨਹੀਂ ਤਾਂ ਬੈਠ ਕੇ ਪੜ੍ਹ ਲਏ

ਪੰਗਾ ਹੀ ਆ ਕੋਈ ਗੱਲ ਨਹੀਂ ਚਲੋ ਵੇਖਦੇ ਹਾਂ ਕੀ ਬਣਦਾ